ਮੈਂ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਸਿੱਖਿਆ ਲੈਣ ਲਈ ਪ੍ਰੇਰਿਤ ਕਰਦੀ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਸਿੱਖਿਆ ਹੀ ਸਾਰੇ ਦਰਵਾਜੇ ਖੋਲ੍ਹਦੀ ਹੈ ਠੀਕ ਹੈ ਨਾਲ ਹੀ ਅਸੀਂ ਅੱਗੇ ਵਧ ਸਕਦੇ ਹਾਂ ਅਤੇ ਤਰੱਕੀ ਕਰ ਸਕਦੇ ਹਾਂ ਕਿਉਂਕਿ ਸਿੱਖਿਆ ਸਾਨੂੰ ਬਹੁਤ ਸਾਰੀਆਂ ਜਗਾਵਾਂ 'ਤੇ ਮਦਦ ਕਰਦੀ ਹੈ ਮੈਂ ਚਾਹੁੰਦੀ ਹਾਂ ਕਿ ਉਹ ਪੋਸਟ ਗਰੈਜੂਏਸ਼ਨ ਕਰੇ ਅਤੇ ਉਹਦੇ ਤੋਂ ਬਾਅਦ ਪੀ ਐੱਚ ਡੀ ਵੀ ਕਰੇ ਕਿਉਂਕਿ ਪੀ ਐੱਚ ਡੀ ਕਰਨ ਨਾਲ ਇੱਕ ਤਾਂ ਵਧੀਆ ਨੌਕਰੀ ਮਿਲ ਸਕਦੀ ਹੈ ਜਿਹਦੇ ਨਾਲ ਅਸੀਂ ਵਧੀਆ ਲਾਈਫ ਸਟਾਈਲ ਸਪੈਂਡ ਕਰ ਸਕਦੇ ਹਾਂ ਅਤੇ ਅੱਗੇ ਅਗਲੀ ਜਨਰੇਸ਼ਨ ਹੋਏਗੀ ਜੋ ਸਾਡੀ ਉਹ ਵੀ ਸਾਡੇ 'ਤੇ ਵਧੀਆ ਮਾਣ ਕਰੇਗੀ ਕਿਉਂਕਿ ਜੇ ਅਸੀਂ ਪੜਾਂਗੇ ਨਹੀਂ ਤਾਂ ਸਾਨੂੰ ਨੌਕਰੀ ਵੀ ਵਧੀਆ ਨਹੀਂ ਮਿਲੇਗੀ ਮੈਂ ਇਹ ਵੀ ਚਾਹੁੰਦੀ ਹਾਂ ਕਿ ਉਹ ਵਧੀਆ ਨੰਬਰਾਂ ਨਾਲ ਪੋਸਟ ਗ੍ਰੈਜੂਏਸ਼ਨ ਕਰੇ ਅਤੇ ਫਿਰ ਸਰਕਾਰੀ ਪੇਪਰਾਂ ਦੀ ਤਿਆਰੀ ਕਰੇ ਜਿਹਦੇ ਨਾਲ ਉਹਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਅਤੇ ਸਰਕਾਰੀ ਨੌਕਰੀ ਨਾਲ ਉਹ ਵਧੀਆ ਆਪਣੀ ਬੱਚਿਆਂ ਜਾਂ ਆਪਣੀ ਵਾਈਫ ਦਾ ਪਾਲਣ ਪੋਸ਼ਣ ਕਰ ਸਕੇ ਜੇ ਇਹ ਸਿੱਖਿਆ ਨਾਲ ਹੀ ਸਾਨੂੰ ਵਧੀਆ ਇੱਜ਼ਤ ਮਿਲਦੀ ਹੈ ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਤਾਂ ਲੋਕ ਤੁਹਾਡੇ 'ਤੇ ਵਿਸ਼ਵਾਸ ਵੀ ਕਰਨਗੇ ਕਿ ਤੁਸੀਂ ਸੱਚ ਹੀ ਬੋਲੋਂਗੇ ਅਤੇ ਜੇ ਤੁਸੀਂ ਪੜ੍ਹੇ ਲਿਖੇ ਨਹੀਂ ਹੋ ਤਾਂ ਲੋਕ ਤੁਹਾਨੂੰ ਐਵੇਂ ਹੀ ਸਮਝਦੇ ਹਨ ਜਿਹਦੇ ਨਾਲ ਸਾਨੂੰ ਵੀ ਵਧੀਆ ਫੀਲ ਨਹੀਂ ਹੁੰਦਾ ਕਿਉਂਕਿ ਕਿ ਜੇ ਇੱਕ ਬੰਦਾ ਗਰੀਬ ਅਤੇ ਅਨਪੜ੍ਹ ਹੈ ਤਾਂ ਉਹਨੂੰ ਸਿਰਫ਼ ਮਜ਼ਦੂਰ ਤੱਕ ਦੀ ਹੀ ਹੈਸੀਅਤ ਨਾਲ ਦੇਖਿਆ ਜਾਂਦਾ ਹੈ ਅਤੇ ਜੇ ਬੰਦਾ ਕੋਈ ਪੜ੍ਹਿਆ ਲਿਖਿਆ ਹੈ ਤਾਂ ਉਹਨੂੰ ਸਾਰੇ ਪਾਸੇ ਸਲਾਮ ਹੁੰਦੀ ਹੈ